ਜੇਕਰ ਰੋਪੜ ਸ਼ਹਿਰ ਦੇ ਵਿਕਾਸ ਦੀ ਗੱਲ ਕਰੀਏ ਤਾਂ ਮੀਂਹ ਜਦੋਂ ਇੱਥੇ ਮੀਂਹ ਪੈਂਦਾ ਹੈ ਤਾਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਗਲ਼ੀਆਂ ਅਤੇ ਨਾਲ਼ੀਆਂ ਦੇ ਗਲ਼ੀਆਂ ਅਤੇ ਨਾਲ਼ੀਆਂ ਦੇ ਵਿੱਚ ਬਹੁਤ ਸਾਰਾ ਪਾਣੀ ਖੜ੍ਹ ਜਾਂਦਾ ਹੈ ਸ਼ਹਿਰ ਦੇ ਵਿੱਚ ਕੋਈ ਪਾਣੀ ਨੂੰ ਕੱਢਣ ਦੇ ਲਈ ਪੁਖਤਾ ਪ੍ਰਬੰਧ ਨਹੀਂ ਹਨ ਜਿਸ ਦੇ ਨਾਲ ਬਹੁਤ ਸਾਰੇ ਆਵਾਜਾਈ ਦੇ ਉੱਤੇ ਬਹੁਤ ਜ਼ਿਆਦਾ ਆਵਾਜਾਈ ਰੁਕ ਜਾਂਦੀ ਹੈ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਦੇ ਲਈ ਬਹੁਤ ਮੁਸ਼ਕਲਾਂ ਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸਾਨੂੰ ਜਿਹੜਾ ਪਾਣ ਪਾਣੀ ਦਾ ਪ੍ਰਬੰ ਪਾਣੀ ਦਾ ਨਿਕਾਸ ਹੈ ਉਹ ਇੱਕ ਸੁਚੱਜਾ ਢੰਗ ਬਣਾਉਣਾ ਚਾਹੀਦਾ ਹੈ ਤਾਂ ਕਿ ਜੋ ਆਮ ਜਨਤਾ ਹੈ ਉਸ ਨੂੰ ਇਸ ਦੇ ਨਾਲ ਕੋਈ ਪਰੇਸ਼ਾਨੀ ਨਾ ਹੋ ਸਕੇ ਅਤੇ ਦੂਜੇ ਪਾਸੇ ਮੈਨੂੰ ਵਿਕਾਸ ਦੇ ਸੰਦਰਭ ਦੇ ਵਿੱਚ ਰੂਪਨਗਰ ਦੇ ਵਿੱਚ ਇਹ ਲੱਗਦਾ ਹੈ ਕਿ ਸੜਕਾਂ ਅਤੇ ਗਲੀਆਂ ਦਾ ਨਿ ਸੜਕਾਂ ਦਾ ਕਾਫ਼ੀ ਨਿਰਮਾਣ ਹੋਇਆ ਹੈ ਅਤੇ ਇੱਥੇ ਬਹੁਤ ਸਾਰੀਆਂ ਚੋੜੀਆਂ ਸੜਕਾਂ ਬਣ ਗਈਆਂ ਨੇ ਅਤੇ ਗੈਸ ਪਾਈਪ ਪੈ ਗੈਸ ਪਾਈਪ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਪੈ ਗਈਆਂ ਨੇ ਅਤੇ ਲੋਕਾਂ ਦੇ ਲਈ ਪਾਰਕ ਜਿਹੜੇ ਨੇ ਉਹ ਬਹੁਤ ਵਧੀਆ ਬਣ ਗਏ ਨੇ ਅਤੇ ਉਹਨਾਂ ਦੇ ਜਿੱਥੇ ਜਿੱਥੇ ਖਾਲੀ ਜਗ੍ਹਾ ਸਰਕਾਰ ਦੀ ਪਈ ਸੀ ਉਹਨਾਂ ਨੇ ਆਪਣੇ ਉੱਥੇ ਪਾਰਕ ਬਣਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਉਸ ਤੋਂ ਬਾ ਉਸ ਤੋਂ ਬਾਅਦ ਮੇਨ ਹੈੱਡ ਵਰਕਰਸ ਜਿਹੜਾ ਹੈ ਬਹੁਤ ਚੰਗੀ ਤਰ੍ਹਾਂ ਉਸ ਦਾ ਵਿਕਾਸ ਹੋਇਆ ਹੈ